ਹਾਂਜੀ ਮੈਂ ਟੈਕਨੋਲੋਜੀ ਇੱਥੇ ਬਾਹਰੀ ਦੁਨੀਆ ਤੋਂ ਡਿਸਕਨੈਟ ਹੋਣ ਲਈ ਇੱਕ ਵਾਰ ਦੋ ਹਜ਼ਾਰ ਤੇਰਾਂ ਦੇ ਵਿੱਚ ਮਨੀਕਰਨ ਸਾਹਿਬ ਗਿਆ ਸੀ ਜਿੱਥੇ ਜਾ ਕੇ ਮੈਨੂੰ ਬੜਾ ਹੀ ਮਨ ਨੂੰ ਸਕੂਨ ਮਿਲਿਆ ਕਿਉਂਕਿ ਇੱਥੇ ਰਹਿ ਕੇ ਮੋਬਾਈਲ ਫੋਨ ਲੈਪਟੋਪ ਚਲਾ ਚਲਾ ਕੇ ਦਿਮਾਗ ਬਹੁਤ ਖ਼ਰਾਬ ਹੋਣ ਲੱਗ ਪਿਆ ਸੀ ਉੱਥੇ ਜਾ ਕੇ ਮੈਂ ਇੱਕ ਤਾਂ ਧਾਰਮਿਕ ਸਥਾਨ 'ਤੇ ਜਾ ਕੇ ਆਪਣਾ ਦਿਮਾਗ ਫਰੈਸ਼ ਕੀਤਾ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਤਿੰਨ ਚਾਰ ਦਿਨ ਰਿਹਾ ਜਿਹਦੇ ਨਾਲ ਮੈਨੂੰ ਬੜਾ ਹੀ ਸਕੂਨ ਮਿਲਿਆ ਕਿਉਂਕਿ ਟੈਕਨੋਲੋਜੀ ਨਾਲ ਕਾਫ਼ੀ ਦੇਰ ਜੁੜੇ ਰਹਿਣ ਨਾਲ ਮਾਇੰਡ ਦਾ ਅਪਸੈਟਿੰਗ ਹੋ ਗਈ ਸੀ ਅਤੇ ਉੱਥੇ ਜਾ ਕੇ ਮੈਂ ਬਹੁਤ ਇੰ ਇੰਜੋਏ ਇੰਜੋਏ ਕੀਤੀ ਲਾਈਫ ਅਤੇ ਉੱਥੇ ਜਾ ਕੇ ਇੱਕ ਤਾਂ ਗਰਮ ਪਾਣੀ ਦੇ ਠੰਡੇ ਪਾਣੀ ਦੇ ਫੁਹਾਰੇ ਸੀ ਜਿ ਜਿਨ੍ਹਾਂ ਦੇ ਵਿੱਚ ਨਹਾਤਾ ਅਤੇ ਮੇਰਾ ਕਾਫ਼ੀ ਅੱਛਾ ਮੈਨੂੰ ਫੀਲ ਹੋਇਆ ਅਤੇ ਇਸ ਤਰ੍ਹਾਂ ਕਰਕੇ ਮੈਨੂੰ ਬੋਡੀ ਦੀ ਕਾਫ਼ੀ ਅੱਛੀ ਗਰੋਥ ਮਿਲੀ ਅਤੇ ਧੰਨਵਾਦ ਜੀ